ਜੰਡਿਆਲੇ ਦੇ ਹੰਗਰ ਪੁਆਇੰਟ ਦੀ ਗੱਲ ਕਰ ਰਿਹਾ ਹਾਂ ਮੈਂ ਇਹਨਾਂ ਦੀ ਰੇਟਿੰਗ ਗੂਗਲ 'ਤੇ ਚੈੱਕ ਕੀਤੀ ਹੈ ਇਹ ਰੈਸਟੋਰੈਂਟ ਦੀ ਰੇਟਿੰਗ ਬਹੁਤ ਹੀ ਜ਼ਿਆਦਾ ਵਧੀਆ ਹੈ ਲੋਕਾਂ ਨੇ ਇਹਨਾਂ 'ਤੇ ਬਹੁਤ ਜ਼ਿਆਦਾ ਕਮੈਂਟ ਕੀਤੇ ਹਨ ਜੋ ਕਿ ਇਹਨਾਂ ਦੇ ਭੋਜਨ 'ਤੇ ਹੈ ਅਤੇ ਇਹਨਾਂ ਦੇ ਓਨਰ 'ਤੇ ਹੈ ਰੈਸਟੋਰੈਂਟ ਦਾ ਓਨਰ ਬਹੁਤ ਹੀ ਸ਼ਾਂਤ ਸੁਭਾਅ ਦਾ ਹੈ ਉਹ ਹਰ ਇੱਕ ਨਾਲ ਪਿਆਰ ਨਾਲ ਪੇਸ਼ ਆਉਂਦਾ ਹੈ ਰੈਸਟੋਰੈਂਟ ਦੇ ਭੋਜਨ ਦੀ ਤਾਰੀਫ਼ ਕੀਤ ਬਹੁਤ ਲੋਕਾਂ ਨੇ ਤਾਰੀਫ਼ ਕੀਤੀ ਹੈ ਸਾਫ਼ ਸੁਥਰਾ ਭੋਜਨ ਬਣਾਉਂਦੇ ਹਨ ਸ਼ੁੱਧ ਸ਼ਾਕਾਹਾਰੀ ਭੋਜਨ ਇੱਥੋਂ ਤਿਆਰ ਹੋ ਕੇ ਡਿਲੀਵਰੀ ਕੀਤਾ ਜਾਂਦਾ ਹੈ ਹੰਗਰੀ ਪੁਆਇੰਟ ਦੀ ਇਹ ਇੱਕ ਖਾਸ ਗੱਲ ਹੈ ਕੀ ਇਹ ਕੋਈ ਹਰ ਇੱਕ ਤਿਉਹਾਰ ਦੇ ਉੱਤੇ ਇਹਨਾਂ ਦੀ ਔਫਰ ਲਗਾਉਂਦੇ ਹਨ ਰੇਟਿੰਗ ਚੈੱਕ ਕਰਨ ਤੋਂ ਬਾਅਦ ਮੈਂ ਵੀ ਔਡਰ ਕੀਤਾ ਭੋਜਨ ਔਡਰ ਕੀਤਾ ਜੋ ਕਿ ਮੈਨੂੰ ਮਿਲਣਾ ਹੈ ਇਸ ਦਾ ਭੋਜਨ ਦੇ ਪੈਕਿੰਗ ਵੀ ਬਹੁਤ ਵਧੀਆ ਕੀਤੀ ਗਈ ਅਤੇ ਭੋਜਨ ਵੀ ਬਹੁਤ ਸਾਫ਼ ਸੁਥਰਾ ਬਣਾਇਆ ਹੋਇਆ ਉੱਥੇ ਕਮੈਂਟ ਲੋਕਾਂ ਨੇ ਕਮੈਂਟ ਵੀ ਕੀਤੇ ਹੋਏ ਸਨ ਕਿ ਇਹਨਾਂ ਦੇ ਭੋਜਨ ਇਹਨਾਂ ਦਾ ਭੋਜਨ ਬਹੁਤ ਹੀ ਸਾਫ਼ ਸੁਥਰੇ ਤਰੀਕੇ ਨਾਲ ਬਣਾਇਆ ਜਾਂਦਾ ਹੈ ਅਤੇ ਬਹੁਤ ਹੀ ਮਿਹਨਤ ਨਾਲ ਹੱਥਾਂ ਵਿੱਚ ਗਲਬਜ਼ ਟੋ ਸਿਰ ਵਿੱਚ ਟੋ ਸਿਰ ਉੱਤੇ ਟੋਪੀ ਪਾ ਕੇ ਬਣਾਇਆ ਜਾਂਦਾ ਹੈ ਅਤੇ ਸਾਫ਼ ਸਫ਼ਾਈ ਦਾ ਵੀ ਸਖ਼ਤ ਧਿਆਨ ਰੱਖਿਆ ਜਾਂਦਾ ਹੈ ਸਵੇਰੇ ਉੱਠ ਕੇ ਵੀ ਇਹ ਪਹਿਲਾਂ ਆ ਕੇ ਆਪਣੇ ਰੈਸਟੋਰੈਂਟ ਦੀ ਸਫ਼ਾਈ ਉੱਥੋਂ ਦਾ ਹਰ ਇੱਕ ਭੋਜਨ ਫਰੈਸ਼ ਬਣਾਉਂਦੇ ਹਨ ਅਤੇ ਲੋਕਾਂ ਨੂੰ ਦਿੰਦੇ ਹਨ ਫਰੈਸ਼ ਭੋਜਨ ਦੇਣ ਨਾਲ ਇਹਨਾਂ ਦੀ ਰੇਟਿੰਗ ਤੇ ਅਤੇ ਇਹਨਾਂ ਦਾ ਰੈਸਟੋਰੈਂਟ ਦਾ ਨਾਮ ਹੋਰ ਜ਼ਿਆਦਾ ਚੱਲਦਾ ਹੈ